ਹਾਂਜੀ ਮੈਂ ਆਪਣੇ ਫੋਨ ਵਿੱਚ ਆਟੋਮੈਟਿਕ ਅਨੁਵਾਦ ਅਤੇ ਗੂਗਲ ਮੈਪਸ ਦੀ ਵਰਤੋਂ ਕੀਤੀ ਹੈ ਅਤੇ ਇਹ ਮੇਰੇ ਲਈ ਬਹੁਤ ਜ਼ਿਆਦਾ ਸਹੀ ਹਨ ਉਦਾਹਰਨ ਦੇ ਤੌਰ 'ਤੇ ਮੈਂ ਆਪਣੇ ਫੋਨ ਦੇ ਵਿੱਚ ਆਟੋਮੈਟਿਕ ਅ ਅਨੁਵਾਦ ਜਿਵੇਂ ਕਿ ਗੂਗਲ ਟਰਾਂਸਲੇਟਰ ਐਪ ਭਰਿਆ ਸੀਗਾ ਪਿਛਲੇ ਸਾਲ ਮੈਂ ਮਲੇਸ਼ੀਆ ਗਈ ਸੀ ਅਤੇ ਉਥੋਂ ਦੀ ਲੈਂਗੁਏਜ ਦਾ ਮੈਨੂੰ ਪਤਾ ਨਹੀਂ ਸੀ ਨਾ ਹੀ ਮੈਨੂੰ ਉਥੋਂ ਦੀ ਲੈਂਗੁਏਜ ਸਮਝ ਆਉਂਦੀ ਸੀ ਅਤੇ ਫਿਰ ਮੈਂ ਆਪਣੇ ਫੋਨ ਦੇ ਵਿੱਚ ਆਟੋਮੈਟਿਕ ਅਨੁਵਾਦ ਗੂਗਲ ਟਰਾਂਸਲੇਟ ਗੂਗਲ ਟਰਾਂਸਲੇਟਰ ਭਰਿਆ ਅਤੇ ਉਸ ਦੇ ਜ਼ਰੀਏ ਮੈਂ ਉਹਨਾਂ ਦੀ ਲੈਂਗੁਏਜ ਨੂੰ ਚੰਗੀ ਤਰ੍ਹਾਂ ਸਮਝ ਸਕੀ ਅਤੇ ਉਸ ਟਾਈਮ ਇਹ ਮੇਰੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਈ ਗੂਗਲ ਮੈਪ ਦੀ ਵਰਤੋਂ ਵੀ ਮੈਂ ਬਹੁਤ ਜਗ੍ਹਾ 'ਤੇ ਕੀਤੀ ਉਦਾਹਰਨ ਦੇ ਲਈ ਪਿਛਲੇ ਸਾਲ ਮੈਂ ਚੰਡੀਗੜ੍ਹ ਗਈ ਸੀ ਅਤੇ ਉੱਥੋਂ ਦੇ ਰਸਤਿਆਂ ਦੇ ਬਾਰੇ ਮੈਨੂੰ ਨੋਲੇਜ ਨਹੀਂ ਸੀ ਮੈਂ ਉੱਥੇ ਅ ਰੋਜ਼ ਗਾਰਡਨ ਜਾਣਾ ਸੀ ਅਤੇ ਉੱਥੇ ਮੈਨੂੰ ਰਾ ਉ ਉੱਥੋਂ ਦੇ ਰਸਤੇ ਦਾ ਮੈਨੂੰ ਕੁਝ ਵੀ ਪਤਾ ਨਹੀਂ ਸੀ ਤਾਂ ਮੈਂ ਆਪਣੇ ਫੋਨ ਦੇ ਉੱਤੇ ਗੂਗਲ ਮੈਪ ਡਾਊਨਲੋਡ ਕੀਤਾ ਅਤੇ ਗੂਗਲ ਮੈਪ ਦੇ ਵਿੱਚ ਜਾ ਕੇ ਮੈਂ ਲੋਕੇਸ਼ਨ ਲਗਾਈ ਅਤੇ ਲੋਕੇਸ਼ਨ ਦੇ ਜ਼ਰੀਏ ਮੈਂ ਆਪਣੇ ਸਹੀ ਟਿਕਾਣੇ 'ਤੇ ਪਹੁੰਚ ਗਈ ਅਤੇ ਇਸ ਤਰ੍ਹਾਂ ਗੂਗਲ ਮੈਪ ਨੇ ਮੇਰੀ ਬਹੁਤ ਜਗ੍ਹਾ ਬਹੁਤ ਸਹਾਇਤਾ ਕੀਤੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਲੇਸਿਸ ਜਗ੍ਹਾ ਹੈਗੀਆਂ ਜਿਹਨਾਂ ਵਿੱਚ ਗੂਗਲ ਮੈਪ ਨੇ ਮੇਰੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਅਤੇ ਮੈਂ ਇਹ ਚਾਹੁੰਦੀ ਹਾਂ ਵੀ ਅੱਗੇ ਤੋਂ ਵੀ ਇੱਦਾਂ ਦੇ ਐਪ ਬਣਨੇ ਚਾਹੀਦੇ ਹਨ ਅਤੇ ਉਹਨਾਂ ਕ੍ਰੀਏਟਰ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇੱਦਾਂ ਦੀ ਐਪਸ ਦੀ ਕ੍ਰਿਟੀਵਿਟੀ ਕੀਤੀ ਅਤੇ ਧੰਨਵਾਦ